ਸਤਿ ਸ਼੍ਰੀ ਅਕਾਲ ਸਰ ਸਰ ਮੈਂ ਤੁਹਾਡੀ ਕੰਪਨੀ ਤੋਂ ਇੱਕ ਪਾਰਸਲ ਮੰਗਵਾਇਆ ਸੀ ਉਸ ਪਾਰਸਲ ਵਿੱਚ ਮੇਰੀ ਇੱਕ ਟੀ ਸ਼ਰਟ ਸੀ ਉਹ ਪਾਰਸਲ ਤਾਂ ਸਾਡੇ ਕੋਲ ਪਹੁੰਚ ਗਿਆ ਪਰ ਜਿਹੜਾ ਡਿਲੀਵਰੀ ਬੋਆਏ ਸਾਡੇ ਘਰ ਪਾਰਸਲ ਦੇਣ ਆਇਆ ਸੀ ਉਸ ਨੇ ਆ ਕੇ ਸਾਡੇ ਘਰ ਦਾ ਦਰਵਾਜ਼ਾ ਖੜਕਾਇਆ ਅਤੇ ਮੇਰੀ ਭੈਣ ਦਰਵਾਜ਼ਾ ਖੋਲ੍ਹਣ ਗਈ ਜਦ ਮੇਰੀ ਭੈਣ ਨੇ ਦਰਵਾਜ਼ਾ ਖੋਲ੍ਹਿਆ ਤਾਂ ਉਹ ਮੇਰੀ ਭੈਣ ਨੂੰ ਬੜੇ ਬੁਰੇ ਤਰੀਕੇ ਨਾਲ ਦੇਖ ਰਿਹਾ ਸੀ ਅਤੇ ਮੇਰੀ ਭੈਣ ਨੂੰ ਪੁੱਛਣ ਲੱਗ ਗਿਆ ਕਿ ਤੁਹਾਡੇ ਘਰ ਕੋਈ ਹੈ ਤਾਂ ਨਹੀਂ ਇਸ ਟਾਈਮ ਤਾਂ ਮੇਰੀ ਭੈਣ ਬੜੀ ਡਰ ਗਈ ਅਤੇ ਉਸਨੇ ਡਰ ਨਾਲ ਦਰਵਾਜ਼ਾ ਬੰਦ ਕਰ ਦਿੱਤਾ ਪਰ ਜਦ ਉਸਨੇ ਇਹ ਗੱਲ ਮੇਰੇ ਮੰਮੀ ਪਾਪਾ ਨੂੰ ਦੱਸੀ ਤਾਂ ਮੇਰੇ ਮੰਮੀ ਪਾਪਾ ਨੇ ਤੁਰੰਤ ਮੈਨੂੰ ਕਾਲ ਕੀਤੀ ਅਤੇ ਦੱਸਿਆ ਕਿ ਜੋ ਡਿਲੀਵਰੀ ਬੋਆਏ ਸੀ ਉਸਦਾ ਸੁਭਾਅ ਬੜਾ ਭੈੜਾ ਸੀ ਉਹ ਬੜੇ ਬੁਰੇ ਤਰੀਕੇ ਨਾਲ ਮੇਰੀ ਭੈਣ ਵੱਲ ਦੇਖ ਰਿਹਾ ਸੀ ਇਸਦੇ ਚਲਦਿਆਂ ਮੇਰੇ ਮੰਮੀ ਪਾਪਾ ਮੈਨੂੰ ਬੋਲਣ ਲੱਗ ਪਏ ਅਤੇ ਕਹਿਣ ਲੱਗ ਪਏ ਤੂੰ ਪਾਰਸਲ ਮੰਗਵਾਉਣਾ ਹੈ ਤਾਂ ਖੁਦ ਆਪ ਲਿਆ ਕਰ ਤਾਂ ਮੈਂ ਤੁਹਾਡੇ ਜਿਹੜੇ ਇਸ ਬੰਦੇ ਤੋਂ ਬੜਾ ਦੁਖੀ ਹਾਂ ਕਿ ਉਸਨੇ ਮੇਰਾ ਅਤੇ ਮੇਰੇ ਘਰਦਿਆਂ ਦਾ ਮਨ ਬਹੁਤ ਦੁਖੀ ਕੀਤਾ ਅਤੇ ਜਿਸ ਕਾਰਨ ਮੇਰਾ ਪਾਰਸਲ ਵੀ ਨਹੀਂ ਮੈਨੂੰ ਮਿਲਿਆ ਅਤੇ ਜਿਸ ਕਾਰਨ ਸਾਡੇ ਘਰ ਵਿੱਚ ਬਹੁਤ ਹੀ ਜ਼ਿਆਦਾ ਲੜਾਈ ਵਾਲਾ ਮਾਹੌਲ ਬਣ ਗਿਆ ਸੋ ਕਿਰਪਾ ਕਰਕੇ ਮੇਰੀ ਇਸ ਗੱਲ ਉੱਤੇ ਧਿਆਨ ਦਿੱਤਾ ਜਾਵੇ